ਹੈਲੋ ਹੈਲੋ ਨਮਸਤੇ ਜੀ ਠੀਕ ਹੈ ਹਾਂਜੀ ਅੱਜ ਕੱਲ੍ਹ ਕੰਮ ਕਿੱਦਾਂ ਹੈ ਚੱਲਦਾ ਪਿਆ ਤੁਹਾਡਾ ਸਾਡਾ ਬੜਾ ਮੰਦਾ ਚੱਲਦਾ ਪਿਆ ਠੀਕ ਹੈ